ਹਾਂਜੀ ਮੇਰੇ ਕੋਲ ਇੱਕ ਮਜ਼ਾਕੀਆ ਕਹਾਣੀ ਹੈ ਸ਼ਾਇਦ ਉਹ ਮੇਰੇ ਲਈ ਮਜ਼ਾਕੀਆ ਹੈ ਤੁਹਾਡੇ ਲਈ ਵੀ ਹੋਵੇਗੀ ਕੁਛ ਟਾਈਮ ਪਹਿਲਾਂ ਅਸੀਂ ਮੇਰੀਆਂ ਮੇਰੀਆਂ ਸਹੇਲੀਆਂ ਅਤੇ ਮੈਂ ਅ ਗਰੁੱਪ ਬਣਾ ਕੇ ਜ਼ੂ ਵਿੱਚ ਗਏ ਸੀ ਅਤੇ ਉੱਥੇ ਉਹਦੇ ਗਾਰਡਨ ਵਿੱਚ ਕਾਫੀ ਪੰਛੀ ਉੱਡ ਰਹੇ ਸੀ ਅਤੇ ਉਹਨਾਂ ਵਿੱਚ ਦੋ ਦੋ ਕਬੂਤਰ ਸੀ ਜਿਨ੍ਹਾਂ ਦੇ ਜਿਨ੍ਹਾਂ ਦੇ ਜਖ਼ਮ ਹੋਏ ਸੀ ਪੰਖਾ 'ਤੇ ਅਤੇ ਪੈਰਾਂ ਵਿੱਚ ਅਤੇ ਅਸੀਂ ਉਹਨਾਂ ਦੀ ਹੈਲਪ ਕੀਤੀ ਉਸ ਟਾਈਮ ਉਹਨਾਂ ਦੀ ਅਸੀਂ ਮਲਮ ਪਟ ਮੱਲਮ ਪੱਟੀ ਕਰਕੇ ਉਹਨਾਂ ਦੇ ਉਹਨਾਂ ਨੂੰ ਉਡਾ ਦਿੱਤਾ ਅਤੇ ਜਦੋਂ ਅਸੀਂ ਵਾਪਸੀ ਵਿੱਚ ਆਏ ਤਾਂ ਕਾਫੀ ਸਾਈਡ 'ਤੇ ਇੱਕ ਕਾਫੀ ਕਾਂਵਾਂ ਦਾ ਝੁੰਡ ਝੁੰਡ ਬੈਠਾ ਹੋਇਆ ਸੀ ਅਤੇ ਜਦੋਂ ਅਸੀਂ ਬਾਅਦ ਜ਼ੂ ਤੋਂ ਬਾਹਰ ਨਿਕਲਣ ਲੱਗੇ ਤਾਂ ਉਹਨਾਂ ਨੇ ਸਾਡੇ ਸਿਰ 'ਤੇ ਠੂੰਗਾਂ ਮਾਰਨੀਆਂ ਸਟਾਰਟ ਕਰ ਦਿੱਤੀਆਂ ਅਤੇ ਅਸੀਂ ਸਾਨੂੰ ਤਾਂ ਬੜਾ ਹਾਸਾ ਆਇਆ ਉਸ ਟਾਈਮ ਕਿ ਹਾਂ ਵੀ ਇਹਨਾਂ ਨੇ ਕਬੂਤਰ ਅਸੀਂ ਕਬੂਤਰਾਂ ਦੀ ਹੈਲਪ ਕੀਤੀ ਤਾਂ ਇਹਨਾਂ ਨੇ ਬਦਲਾ ਲਿਆ ਕਿ ਉਹਨਾਂ ਦੀ ਹੈਲਪ ਕਿਉਂ ਕੀਤੀ ਹੋਈ ਅਤੇ ਅੱਜ ਵੀ ਅਸੀਂ ਅਸੀਂ ਸਹੇਲੀਆਂ ਇਕੱਠੀਆਂ ਹੁੰਦੀਆਂ ਅਤੇ ਅਸੀਂ ਕਈ ਵੇਲੇ ਜੂਹ ਦੀਆਂ ਜ਼ੂ ਦੀਆਂ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਮਜ਼ਾਕੀਆ ਮਜ਼ਾਕੀਆ ਇੰਸੀਡੈਂਟ ਸਾਨੂੰ ਯਾਦ ਆ ਜਾਂਦਾ ਕਿ ਹਾਂ ਵੀ ਉਸ ਟਾਈਮ ਇਹ ਚੀਜ਼ਾਂ ਹੋਈਆਂ ਸੀ